ਹਾਂ ਸਾਡੇ ਪਿੰਡ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਖੁੱਲੇ ਵਿੱਚ ਪਖਾਨਾ ਜਾਣਾ ਆਮ ਗੱਲ ਸੀ ਕਿਉਂਕੀ ਲੋਕ ਗਰੀਬ ਹੋਣ ਕਰਕੇ ਅਤੇ ਘਰਾਂ ਵਿੱਚ ਪਖਾਨੇ ਨਾ ਹੋਣ ਕਰਕੇ ਲੋਕ ਖੁੱਲੇ ਵਿੱਚ ਜਾਣਾ ਜ਼ਿਆਦਾ ਪਸੰਦ ਕਰਦੇ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਸ ਦੇ ਨੁਕਸਾਨ ਲੋਕਾਂ ਦੇ ਸਾਹਮਣੇ ਆਉਣ ਲੱਗੇ ਇਸ ਨਾਲ ਇੱਕ ਤਾਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਦੂਜਾ ਲੋਕੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਇਸ ਨਾਲ ਹੋਣ ਵਾਲੇ ਨੁਕਸਾਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਲੱਗੇ ਇਸ ਕਰਕੇ ਲੋਕਾਂ ਨੇ ਖੁੱਲੇ ਵਿੱਚ ਪਖਾਨਾ ਜਾਣਾ ਬੰਦ ਕਰ ਦਿੱਤਾ ਇਹਨਾਂ ਦੇ ਨੁਕਸਾਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਘਰਾਂ ਵਿੱਚ ਹੀ ਪਖਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ